ਅਸੀਂ ਵਰਤਮਾਨ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਜਿਵੇਂ ਕੀ ਬੇਰੁਜ਼ਗਾਰੀ ਕੰਮ ਨਾ ਮਿਲਣਾ ਪੜ੍ਹ ਲਿਖ ਕੇ ਬੇਰੁਜ਼ਗਾਰ ਰਹਿਣਾ ਡਿਗਰੀਆਂ ਦਾ ਕੋਈ ਮੁੱਲ ਨਾ ਪੈਣਾ ਉੱਪਰੋਂ ਵੱਧ ਰਹੀਆਂ ਲੋੜਾਂ ਵੱਧ ਰਹੀ ਮਹਿੰਗਾਈ ਅਤੇ ਹਰ ਇੱਕ ਕੰਮ ਵਿੱਚ ਮੁਕਾਬਲਾ ਬਹੁਤ ਸਾਰੀਆਂ ਚੁਣੌਤੀਆਂ ਹਨ ਪਰ ਇਹਨਾਂ ਨੂੰ ਦੂਰ ਕਰਨ ਦੀ ਉਮੀਦ ਵੀ ਕਰ ਰਹੇ ਹਾਂ ਕਿ ਅੱਜ ਨਹੀਂ ਤਾਂ ਕੱਲ੍ਹ ਉਮੀਦ ਪੂਰੀ ਵੀ ਹੋ ਸਕਦੀ ਹੈ ਬਾਕੀ ਬੇਰੁਜ਼ਗਾਰੀ ਸਭ ਤੋਂ ਵੱਡੀ ਚੁਣੌਤੀ ਹੈ ਜੋ ਪੂਰੀ ਹੋਣੀ ਚਾਹੀਦੀ ਹੈ ਬਾਕੀ ਅਸੀਂ ਸਰਕਾਰ ਵੱਲ ਵੀ ਦੇਖ ਰਹੇ ਹਾਂ ਬਾਕੀ ਆਪ ਵੀ ਕੋਸ਼ਿਸ਼ ਤਾਂ ਕਰਦੇ ਹੀ ਰਹੇ ਹੁਣ ਤੱਕ ਕਰਦੇ ਵੀ ਆਏ ਅਤੇ ਅੱਗੇ ਵੀ ਕਰਦੇ ਹੀ ਰਹਾਂਗੇ ਉਮੀਦ ਤਾਂ ਹਰ ਇੱਕ ਨੂੰ ਹੁੰਦੀ ਹੈ ਬਾਕੀ ਦੇਖਦੇ ਹਾਂ ਅੱਗੇ ਕੀ ਬਣਦਾ